ਸਾਡੇ ਖੇਤਰ ਵਿੱਚ ਕਲਾ ਅਤੇ ਸੱਭਿਆਚਾਰਕ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਵੇਂ ਕਿ ਵਿਸਾਖੀ ਦਾ ਮੇਲਾ ਬਸੰਤ ਪੰਚਮੀ ਗੁਰੂਆਂ ਦੇ ਗੁਰਪੁਰਬ ਸਾਵਨ ਦਾ ਤਿਉਹਾਰ ਪੀਰਾਂ ਦੇ ਮੇਲੇ ਸੰਗੀਤ ਮੇਲੇ ਪੱਗਾਂ ਦੇ ਮੁਕਾਬਲੇ ਕਬੱਡੀ ਦੇ ਮੁਕਾਬਲੇ ਲੋਕ ਨਾਚ ਆਦਿ ਕਰਵਾਏ ਜਾਂਦੇ ਹਨ ਇਹਨਾਂ ਮੇਲਿਆਂ ਅਤੇ ਮੁਕਾਬਲੇ ਦੇ ਮੌਕਿਆਂ 'ਤੇ ਪੈਸੇ ਦਾ ਪ੍ਰਬੰਧ ਸਾਰੇ ਖੇਤਰ ਵੱਲੋਂ ਆਪਣੀ ਆਮਦਨ ਵਿੱਚ ਕੁਝ ਹਿੱਸਾ ਕੱਢ ਕੇ ਦਿੱਤਾ ਜਾਂਦਾ ਹੈ ਅਤੇ ਪਿੰਡ ਦੇ ਸਰਪੰਚਾਂ ਵੱਲੋਂ ਵੀ ਪਿੰਡ ਦਾ ਪ੍ਰਬੰਧ ਪਿੰਡ ਦੀ ਗਰਾਹੀ ਰਾਹੀਂ ਕੀਤਾ ਜਾਂਦਾ ਹੈ ਸਾਡੇ ਵਿਦੇਸ਼ ਵਿੱਚ ਰਹਿਣ ਵਾਲੇ ਸੱਜਣ ਮਿੱਤਰ ਵੀ ਦਾਨ ਲੋਕਾਂ ਲੋਕ ਵੀ ਪੈਸੇ ਦਾ ਪ੍ਰਬੰਧ ਕਰਦੇ ਹਨ ਜਿਹੜੇ ਸਰਕਾਰ ਵੱਲੋਂ ਪ੍ਰੋਗਰਾਮ ਚਾਲੂ ਕੀਤੇ ਜਾਂਦੇ ਹਨ ਉਸ ਵਿੱਚ ਵੀ ਸਰਕਾਰ ਹੀ ਪੈਸਿਆਂ ਦਾ ਪ੍ਰਬੰਧ ਕਰਦੀ ਹੈ ਜੇਕਰ ਹੋਰ ਕੋਈ ਵੀ ਦਾਨੀ ਪੈਸਿਆਂ ਰਾਹੀਂ ਪ੍ਰੋਗਰਾਮਾਂ ਦਾ ਪ੍ਰਬੰਧ ਕਰਦੇ ਹਨ